ਪਟਿਆਲਾ ਇੱਕ ਪ੍ਰਸਿੱਧ ਸ਼ਹਿਰ ਹੈ ਜਿਸ ਵਿੱਚ ਕਿਲ੍ਹਾ ਮੁਬਾਰਕ ਵੀ ਹੈ ਇਹ ਸਭ ਦਾ ਸਾਂਝਾ ਸ਼ਹਿਰ ਹੈ ਇਸ ਵਿੱਚ ਗੁਰਦੁਆਰਾ ਮੰਦਰ ਮਸਜਿਦ ਸਭ ਕੁਛ ਸ਼ਾਮਿਲ ਹੁੰਦਾ ਹੈ ਉਰੇ ਹਰ ਇੱਕ ਧਰਮ ਦਾ ਬੰਦਾ ਤੁਹਾਨੂੰ ਮਿਲ ਜਾਵੇਗਾ ਅਤੇ ਕਿਸੇ ਵਿੱਚ ਕੋਈ ਭੇਦ ਭਾਵ ਨਹੀਂ ਹੁੰਦਾ ਅਤੇ ਸਾਰੇ ਮਿਲ ਜੁਲ ਕੇ ਰਹਿੰਦੇ ਹਨ ਪਟਿਆਲਾ ਇੱਕ ਬਹੁਤ ਹੀ ਸੋਹਣਾ ਸ਼ਹਿਰ ਹੈ ਇਸ ਪਟਿਆਲੇ ਵਿੱਚ ਕਿਲ੍ਹੇ ਵਿੱਚ ਇੱਕ ਬਹੁਤ ਚਿਰਾਂ ਤੋਂ ਜੋਤ ਵੀ ਚਲਦੀ ਹੈ ਜੋ ਕਿ ਮੰਨਿਆ ਜਾਂਦਾ ਹੈ ਜਿਸ ਨੇ ਪਟਿਆਲੇ ਦੀ ਨੀਂਹ ਰੱਖੀ ਸੀ ਉਸ ਨੇ ਇਹ ਜੋਤ ਪ੍ਰਜਵੱਲਿਤ ਕੀਤੀ ਸੀ ਧੰਨਵਾਦ